ਖੇਡਾਂ ਵਿੱਚ ਵੈਸੇ ਤਾਂ ਬਚਪਨ ਤੋਂ ਹੀ ਹਰ ਇੱਕ ਨੂੰ ਧਿਆਨ ਰੱਖਣਾ ਚਾਹੀਦਾ ਹੈ ਧਿਆਨ ਦੇਣਾ ਚਾਹੀਦਾ ਹੈ ਸ਼ੌਂਕ ਖੇਡਾਂ ਦਾ ਸ਼ੌਂਕ ਰੱਖਣਾ ਚਾਹੀਦਾ ਹੈ ਜੋ ਕਿ ਖੇਡਾਂ ਦੇ ਵਿੱਚ ਬਚਪਨ ਤੋਂ ਹੀ ਸ਼ੌਂਕ ਹੋਣ ਕਾਰਨ ਅੱਗੇ ਵਧਦਾ ਹੈ ਜਿਹਦੇ ਨਾਲ ਪਹਿਲਾਂ ਡਿਸਟਿਕ ਲੈਵਲ 'ਤੇ ਕੋਈ ਖੇਡ ਖੇਡੇਗਾ ਨੈਸ਼ਨਲ ਲੈਵਲ 'ਤੇ ਖੇਡੇਗਾ ਸਟੇਟ ਲੈਵਲ 'ਤੇ ਖੇਡੇਗਾ ਇੰਟਰਨੈਸ਼ਨਲ ਲੈਵਲ ਤੱਕ ਫਿਰ ਖੇਡੇਗਾ ਫਿਰ ਉਸਦੀਆਂ ਸਹੂਲਤਾਂ ਵੀ ਉਸਨੂੰ ਪ੍ਰਾਪਤ ਹੋਣਗੀਆਂ ਜਿਵੇਂ ਕਿ ਸਰਕਾਰੀ ਨੌਕਰੀ ਵਗੈਰਾ ਆਦਿ ਹਰ ਇੱਕ ਚੀਜ਼ ਕਿਸੇ ਵੀ ਚੀਜ਼ ਤੋਂ ਉਹਨੂੰ ਪਰੇਸ਼ਾਨੀ ਨਹੀਂ ਹੋਊਗੀ ਇਸ ਕਰਕੇ ਹਰ ਇੱਕ ਨੂੰ ਖੇਡਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਖੇਡਾਂ ਦੇ ਨਾਲ ਫਿਟਨੈਸ ਦਾ ਵੀ ਖਿਆਲ ਰਖ ਰਹਿੰਦਾ ਹੈ ਜਿਸ ਦੇ ਨਾਲ ਨਸ਼ ਜਿਵੇਂ ਅੱਜ ਜਵਾਨੀ ਜ ਨਸ਼ਿਆਂ ਵੱਲ ਜਾ ਰਹੀ ਹੈ ਖੇਡਾਂ ਨਾਲ ਧਿਆਨ ਇਸ ਕੰਮਾਂ ਡ ਵੱਲ ਨਹੀਂ ਜਾਂਦਾ